ਅਰੋਬਿਸ 'ਤੇ ਭੰਗੜਾ ਪਾਉਣਾ ਕੋਈ ਗਲਤ ਤਾਂ ਨਹੀਂ ਆ ਪਰ ਚਲੋ ਕੀ ਹਾਂ ਕੀ ਹੁੰਦਾ ਵਾ ਕਿ ਧਿਆਨ ਉੱਧਰ ਹੋਵੇ ਕੋਈ ਐਕਸਰਸਾਈਜ਼ ਕਰਦੇ ਹਾਂ ਪਰ ਮ ਮੈਨੂੰ ਤਾਂ ਵਧੀਆ ਲੱਗਦਾ ਵਾ ਐਕਸਰਸਾਈਜ਼ ਕਰਦੇ ਹਾਂ ਭੰਗੜਾ ਲੱਗਾ ਹੋਵੇ ਦਿਲਜੀਤ ਦੇ ਗਾਣੇ ਲੱਗੇ ਹੋਣ ਉਹ 'ਤੇ ਭੰਗੜਾ ਕਰਨਾ ਅਤੇ ਅੱਛਾ ਲੱਗਦਾ ਵਾ ਬਾਕੀ ਹਰ ਇੱਕ ਦੀ ਆਪਣੀ ਆਪਣੀ ਚੀਜ਼ ਹੁੰਦੀ ਆ ਕਿ ਚਲੋ ਠੀਕ ਆ ਨਹੀਂ ਪਰ ਇਹ ਗਲਤ ਆ ਕਿ ਨਹੀਂ ਐਕਸਰਸਾਈਜ਼ ਕਰਦੇ ਹਾਂ ਭੰਗੜਾ ਵਧੀਆ ਹੀ ਲੱਗਦਾ ਵਾ ਕਿ ਮੇਰਾ ਪਰਸਨਲ ਆ ਕਿ ਮੈਂ ਤਾਂ ਐਕਸਰਸਾਈਜ਼ ਕਰਦੇ ਆ ਵੀ ਭੰਗੜੇ ਦੇ ਵਿੱਚ ਸਟੈੱਪ ਕਰਨ ਲੱਗ ਜਾਂਦੀ ਹਾਂ ਅਤੇ ਚਲੋ ਕੀ ਅੱਛੀ ਗੱਲ ਆ ਅਤੇ ਪਰ ਮੈਨੂੰ ਵਧੀਆ ਲੱਗਦਾ ਵਾ ਕਿ ਭੰਗੜਾ ਕਰਨਾ ਅਤੇ ਐਕਸਰਸਾਈਜ਼ ਕਰਨੀ ਉੱਤੇ ਭੰਗੜਾ ਪਾਉਣਾ ਕਿ ਬਹੁਤ ਵਧੀਆ ਗੱਲ ਆ ਅਤੇ ਮੇਰੇ ਅਨੁਸਾਰ ਤਾਂ ਨਹੀਂ ਕੋਈ ਗਲਤ ਧਾਰਨਾ ਹੋਣੀ ਚਾਹੀਦੀ ਇਹ ਬਾਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਕਿ ਉਹ ਉਹਨੂੰ ਕਿਸ ਨਜ਼ਰੀਏ ਨਾਲ ਦੇਖਦਾ ਆ ਅਤੇ ਪਰ ਅੱਛੀ ਗੱਲ ਆ ਕਿ ਤੁਸੀਂ ਕਰ ਰਹੇ ਹੋ ਤਾਂ ਕਰੋ ਇੰਜੋਏ ਯੂਅਰ ਐਕਸਸਾਈਜ਼ ਭੰਗੜਾ ਸਭ ਕੁਛ ਇੰਜੋਏ ਕਰੋ